ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਵਧੀਆ ਹਾਂਜੀ ਮਿਲਜੂਗੀ ਉਹ ਜੀ ਕਿਹੜੀ ਚਾਹੀਦੀ ਕਿਹੜੀ ਹੈ ਕੀ ਕਿੰਨੇ ਕਿੰਨੇ ਕੁ ਪੈਸੇ ਲਾਣੇ ਐ ਭਰਾ ਆਪਾਂ ਕੋਈ ਗੱਲ ਨੀ ਮਿਲਜੇ ਮਿਲਜੇਗੀ ਜੀ ਮਿਲਜੇਗੀ ਤੁਸੀਂ ਜਦ ਮਰਜ਼ੀ ਵਿਜ਼ਿਟ ਕਰਲੋ ਮੈਂ ਤੁਹਾਨੂੰ ਲੋਕੇਸ਼ਨ ਸ਼ੇਅਰ ਕਰ ਦਿੰਦਾ